ਬਰੋਟਾ ਫਾਰਮ ਜਿਹੜਾ ਕਿ ਪੰਜਾਬ ਦਾ ਵਿਲੱਖਣ ਰਿਹਾਇਸ਼ ਹੈ ਜਿੱਥੇ ਲੋਕ ਸੈਲਾਨੀ ਘੁੰਮਣ ਆਉਂਦੇ ਹਨ ਉੱਥੇ ਬਹੁਤ ਸਾਰੇ ਦਰੱਖਤ ਲੱਗੇ ਹੋਏ ਹਨ ਜੋ ਬਹੁਤ ਸਾਰੇ ਜੰਗਲੀ ਜਾਨਵਰ ਵੀ ਰਹਿੰਦੇ ਹਨ ਜਿਹੜਾ ਆ ਇਹ ਰੋਪੜ ਵਿੱਚ ਪੈਂਦਾ ਆ ਇੱਥੇ ਬਹੁਤ ਸਾਰੇ ਜਾਨਵਰ ਆ ਜਿੱਦਾਂ ਹਿਰਨ ਆ ਔਰ ਰਿਹਾਇਸ਼ ਵੀ ਆ ਉੱਥੇ ਤੋਤੇ ਵੀ ਬਹੁਤ ਸੋਹਣੇ ਸੋਹਣੇ ਹਨ ਮੈਂ ਜਦੋਂ ਦੇਖਿਆ ਤਾਂ ਉੱਥੇ ਕਾਫੀ ਸਾਰੇ ਫੁੱਲ ਵੀ ਲੱਗੇ ਹੋਣ ਉੱਥੇ ਇੱਕ ਪਾਰਕ ਵੀ ਬਹੁਤ ਵੱਡੀ ਬਣੀ ਹੋਈ ਹੈ ਅਤੇ ਕਾਫੀ ਸਾਰੇ ਲੋਕ ਉੱਥੇ ਘੁੰਮਣ ਜਾਂਦੇ ਆ ਮੇਰਾ ਅਨੁਭਵ ਬਹੁਤ ਵਧੀਆ ਰਿਹਾ ਉੱਥੇ ਜਾਣ ਦਾ ਹੋਮਸੈਟ ਦੀ ਗੱਲ ਕਰੀਏ ਤਾਂ ਉੱਥੇ ਲੋਕ ਜਾ ਕੇ ਰਹਿਣਾ ਵੀ ਪਸੰਦ ਕਰਦੇ ਹਨ ਇੱਥੇ ਬਹੁਤ ਜ਼ਿਆਦਾ ਟ੍ਰੀ ਹੋਣ ਦੇ ਨਾਲ ਨਾਲ ਉੱਥੇ ਖੂਬਸੂਰਤ ਵੀ ਬਹੁਤ ਲੱਗਦਾ ਹੈ ਜਿਹੜੇ ਦਰੱਖਤ ਹਨ ਉਹ ਸਾਨੂੰ ਬਹੁਤ ਵਧੀਆ ਲੱਗਦੇ ਹਨ ਅਤੇ ਬਰੋਟਾ ਫਾਰਮ ਵੀ ਬਹੁਤ ਵਧੀਆ ਏ ਆ ਜਿਹੜਾ ਕਿੱਕਰ ਫਾਰਮ ਏ ਇਹ ਰੋਪੜ ਦੇ ਕੋਲ ਪੈਂਦਾ ਏ ਆ ਅਤੇ ਬਹੁਤ ਹੀ ਵਧੀਆ ਲੱਗਦਾ ਆ ਸਾਨੂੰ ਦੇਖਣ ਨੂੰ ਅਤੇ ਘੁੰਮਣ ਨੂੰ ਉੱਥੇ ਮਨ ਨੂੰ ਸ਼ਾਂਤੀ ਮਿਲਦੀ ਆ ਜਾ ਕੇ ਬਹੁਤ ਹੀ ਵਧੀਆ ਲੱਗਿਆ ਮੈਨੂੰ ਉੱਥੇ ਜਾ ਕੇ ਜੋ ਕਿ ਮੇਰਾ ਅਨੁਭਵ ਬਹੁਤ ਵਧੀਆ ਸੀ ਉੱਥੇ ਜਾਣ ਦਾ